ਅੱਜ ਕੱਲ੍ਹ ਸਾਡੇ ਜਿਹੜੇ ਮਤਲਬ ਕਿ ਪੇਂਡੂ ਖੇਤਰ ਹੈ ਇਹਦੇ ਵਿੱਚ ਕਿਆ ਹੈ ਅੱਜ ਕੱਲ੍ਹ ਮਤਲਬ ਨੀਤੀ ਏਜੰਟਸ ਹੋ ਗਏ ਨੀਤੀ ਏਜੰਟਸ ਵਰਗੇ ਹੋਰ ਵੀ ਬਹੁਤ ਸਾਰੇ ਏਜੰਟ ਆ ਜਿੱਦਾਂ ਕਿ ਲੋਨ ਏਜੰਟਸ ਹੋ ਗਏ ਇਹ ਸਾਡੇ ਮਤਲਬ ਪਿੰਡਾਂ ਦੇ ਵਿੱਚ ਆਮ ਹੀ ਘੁੰਮਦੇ ਰਹਿੰਦੇ ਹਨ ਅਤੇ ਉਹ ਕਹਿੰਦੇ ਹਨ ਕਿ ਤੁਸੀਂ ਲੋਨ ਲੈ ਲਓ ਬੀਮਾਂ ਕਰ ਲਓ ਹੈ ਨਾ ਅਤੇ ਮਤਲਬ ਜਿੱਦਾਂ ਕਿ ਅਸੀਂ ਉਦਾਹਰਨ ਦੇ ਤੌਰ 'ਤੇ ਲੈ ਲਈਏ ਜਿੱਦਾਂ ਕਿ ਆਪਾਂ ਲੈ ਲਈਏ ਉਹਨਾਂ ਨੂੰ ਲੋਨ ਵਾਲਿਆਂ ਨੂੰ ਠੀਕ ਹੈ ਅਤੇ ਪਿੰਡਾਂ ਦੇ ਵਿੱਚ ਅੱਧੇ ਲੋਕ ਅਜਿਹੇ ਹੁੰਦੇ ਆ ਜਿਹੜੇ ਕਿ ਪੜ੍ਹੇ ਲਿਖੇ ਨਹੀਂ ਹੁੰਦੇ ਹਨ ਅਤੇ ਉਹ ਨਾ ਉਹਨਾਂ ਦੇ ਨਾ ਪੜ੍ਹੇ ਹੋਣ ਦੇ ਕਰਕੇ ਇਹ ਕਿਆ ਏ ਕਿ ਜਿੱਦਾਂ ਕਿ ਉਹ ਉਹਨਾਂ ਨੂੰ ਕੋਈ ਵੀ ਗੱਲ ਸਮਝਾਉਂਦੇ ਹਨ ਉਹ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਸਮਝਾਉਂਦੇ ਆ ਜਿੱਦਾਂ ਕਿ ਇੰਗਲਿਸ਼ ਦੇ ਵਿੱਚ ਸਮਝਾ ਦਿੰਦੇ ਹਨ ਠੀਕ ਹੈ ਪਰ ਜਿਹੜੇ ਉਹ ਦਸਤਾਵੇਜ਼ ਹੁੰਦੇ ਹਨ ਉਹਨਾਂ ਦੇ ਉੱਤੇ ਇੰਗਲਿਸ਼ 'ਚ ਲਿਖਿਆ ਵਾ ਹੁੰਦਾ ਚੱਲ ਜੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਸਮਝਾ ਵੀ ਦਿੰਦੇ ਹਨ ਪਰੰਤੂ ਫਿਰ ਵੀ ਉਹ ਕਿਆ ਹੈ ਚੰਗੀ ਤਰ੍ਹਾਂ ਸਮਝਾ ਨਹੀਂ ਪਾਉਂਦੇ ਕਿਉਂਕਿ ਦਸਤਾਂ ਦੇ ਦਸਤਾਵੇਜ਼ ਜੋ ਵੀ ਹੁੰਦੇ ਆ ਉਹਨਾਂ ਦੇ ਵਿੱਚ ਉਹ ਚੀਜ਼ ਨਹੀਂ ਲਿਖੀ ਵੀ ਹੁੰਦੀ ਹੈ ਜੋ ਰੀਅਲ ਮਾ ਹੁੰਦੀ ਹੈ ਜੋ ਮਤਲਬ ਸੱਚਾਈ ਹੁੰਦੀ ਹੈ ਉਹ ਉਹਨਾਂ ਨੂੰ ਕੁਝ ਵੀ ਸਮਝਾ ਦਿੰਦੇ ਜੋ ਕਿ ਚੰਗੀ ਤਰ੍ਹਾਂ ਸਮਝ ਨਹੀਂ ਪਾਉਂਦੇ ਪਿੰਡਾਂ ਦੇ ਲੋਕ ਥੋੜ੍ਹੇ ਅਜਿਹੇ ਹੁੰਦੇ ਹਨ ਜਿਹੜੇ ਕਿ ਮਤਲਬ ਲੋਕਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਜਲਦੀ ਆ ਜਾਂਦੇ ਉਹ ਲੋਕਾਂ ਦੀ ਗੱਲਾਂ ਦੇ ਵਿੱਚ ਆ ਕੇ ਕਿਆ ਏ ਉਹਨਾਂ ਦੀਆਂ ਗੱਲਾਂ 'ਤੇ ਭਰੋਸਾ ਕਰਕੇ ਉਹਨਾਂ 'ਤੇ ਯਕੀਨ ਕਰ ਲੈਂਦੇ ਇਹ ਕਿਆ ਏ ਜਿੱਦਾਂ ਕਿ ਹੁਣ ਬੀਮਾ ਲਾ ਲਓ ਠੀਕ ਹੈ ਉਹ ਬੀਮਾ ਕਰ ਲੈਂਦੇ ਆ ਠੀਕ ਹੈ ਨਾਲ ਲੋਨ ਲੈ ਲੈਂਦੇ ਆ ਨੀਤੀ ਏਜੰਟਸ ਹੋਗੇ ਆ ਅਤੇ ਇਹਨਾਂ ਦੇ ਉੱਤੇ ਭਰੋਸਾ ਕਰਕੇ ਉਹ ਕਿਆ ਏ ਜਿੱਦਾਂ ਕੀ ਹੁਣ ਆਪਾਂ ਲਈਏ ਬੀਮਾ ਵਾਲਿਆਂ ਨੂੰ ਠੀਕ ਹੈ ਬੀਮਾ ਕਰਵਾ ਲੈਂਦੇ ਆ ਜਿਹਨਾ ਅਤੇ ਕਿਆ ਏ ਉਹਨਾਂ ਨੂੰ ਜਾ ਮਤਲਬ ਉਹਨਾਂ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਆਮ ਲੋਕ ਹੁੰਦੇ ਆ ਨਾ ਉਹਨਾਂ ਨੂੰ ਉਹਦਾ ਕੋਈ ਵੀ ਲਾਭ ਨਹੀਂ ਹੁੰਦਾ ਜਿਹੜਾ ਉਹ ਲਾਭ ਹੁੰਦਾ ਹੈ ਨਾ ਉਹ ਦੂਜੇ ਲੋਕਾਂ ਨੂੰ ਹੀ ਹੁੰਦਾ ਜਿਹੜੇ ਕਿ ਉਹ ਏਜੰਟ ਹੁੰਦਾ ਲਾਭ ਉਹਨੂੰ ਹੀ ਹੁੰਦਾ ਹੈ ਪਰ ਉਹਨਾਂ ਨੂੰ ਗੱਲਾਂ ਦੇ ਵਿੱਚ ਪਾ ਕੇ ਪਾਗਲ ਬਣਾ ਦਿੰਦੇ ਹਨ ਇਸੇ ਤਰ੍ਹਾਂ ਕਿਆ ਹੈ ਜਿੱਦਾਂ ਕਿ ਲੋਨ ਏਜੰਟ ਹੋ ਗਏ ਆ ਲੋਨ ਏਜੰਟ ਅਜਿਹੀ ਭਾਸ਼ਾ ਦਾ ਯੂਜ ਮਤਲਬ ਖੇਤਰੀ ਭਾਸ਼ਾ ਦਾ ਯੂਜ ਨਹੀਂ ਕਰਦੇ ਖੇਤਰੀ ਭਾਸ਼ਾ ਦਾ ਯੂ ਮਤਲਬ ਵਰਤੋਂ ਨਾ ਹੋਣ ਦੇ ਕਰਕੇ ਕਿਆ ਏ ਬਹੁਤ ਸਾਰੀਆਂ ਜਿਹੜੀਆਂ ਕਿਆ ਏ ਪਰੇਸ਼ਾਨੀਆਂ ਆਉਂਦੀਆਂ ਅਤੇ ਉਹ ਪਰੇਸ਼ਾਨੀਆਂ ਜਿਹੜੀਆਂ ਦੇਖਦਾ ਕੌਣ ਹੈ ਉਹ ਪਿੰਡਾਂ ਦੇ ਲੋਕ ਦੇਖਦੇ ਨੇ ਇਸ ਲਈ ਕਿਆ ਏ ਜਿਹੜੀ ਉਹ ਖੇਤਰੀ ਭਾਸ਼ਾ ਏ ਇਹ ਸਾਡੀ ਜਿਹੜੀ ਪੰਜਾਬੀ ਹੈ ਇਹ ਖੇਤਰੀ ਭਾਸ਼ਾ ਸਾਡੀ ਪੰਜਾਬੀ ਇਹਦੀ ਵਰਤੋਂ ਮਤਲਬ ਕਿਆ ਹੋਣੀ ਚਾਹੀਦੀ ਹੈ ਜਿਹੜੇ ਦਸਤਾਵੇਜ਼ ਹੈ ਇਹ ਦਸਤਾਵੇਜ਼ ਆ ਜਿਹੜੇ ਉਹ ਕਿਆ ਏ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਹਨ ਪੰਜਾਬੀ ਵਿੱਚ ਹੋਣ ਦੇ ਕਰਕੇ ਕਿਆ ਏ ਇਹ ਲੋਕ ਉਹਨਾਂ ਨੂੰ ਪੜ੍ਹ ਕੇ ਮਤਲਬ ਸੱਚਾਈ ਸੋ ਮਤਲਬ ਸਮਝ ਸਕਣ ਕਿ ਹਾਂ ਜੋ ਰੀਅਲ ਮਾ ਮਤਲਬ ਸੱਚਾਈ ਜੋ ਰੀਅਲ ਸੱਚਾਈ ਹੈ ਉਹ ਹੈ ਕਿਆ ਏ ਅਤੇ ਫਿਰ ਉਹ ਮਤਲਬ ਉਹਨਾਂ ਦੇ ਉੱਤੇ ਭਰੋਸਾ ਨਾ ਕਰਨ ਭਰੋਸਾ ਨਾ ਕਰਨ ਅਤੇ ਜੋ ਵੀ ਹੈ ਜਿੱਦਾਂ ਕਿ ਹੁਣ ਲੋਨ ਵਾਲੇ ਆ ਉਹ ਲੋਨ ਦੇ ਦਿੰਦੇ ਆ ਠੀਕ ਹੈ ਲੋਨ ਦੇਣ ਦੇ ਨਾਲ ਕਿਆ ਏ ਲੋਨ ਦੇ ਕੇ ਉਹ ਕਿਆ ਏ ਉਹਨਾਂ ਨੂੰ ਜ਼ਿਆਦਾ ਇੰਟਰਸਟ ਦੇਣਾ ਪੈਂਦਾ ਜ਼ਿਆਦਾ ਵਿਆਜ ਦੇਣਾ ਪੈਂਦਾ ਲੋਕਾਂ ਨੂੰ ਅਤੇ ਫਿਰ ਉਹ ਅਜਿਹੀ ਲੋਨ ਦਾ ਵੀ ਕਿਆ ਫਾਇਦਾ ਹੈ ਨਾ ਜਿਹੜਾ ਕਿ ਆਪਾਂ ਉਹਦਾ ਜ਼ਿਆਦਾ ਮਤਲਬ ਲੋਨ ਦਈਏ ਅਤੇ ਜਿਹੜਾ ਉਹ ਵਿਅਕਤੀ ਹੈ ਜਿਹਨੇ ਲੋਨ ਲਿਆ ਏ ਉਹਨੂੰ ਹਾਨੀ ਹੋਵੇ ਹੈ ਨਾ ਲੋਨ ਤਾਂ ਲੈ ਲਿਆ ਪਰ ਵਿਆਜ ਤਾਂ ਜ਼ਿਆਦਾ ਦੇਣਾ ਪੈ ਰਿਹਾ ਨਾ ਇੱਦਾਂ ਫਿਰ ਏਜੰਟ ਨੂੰ ਤਾਂ ਫਾਇਦਾ ਹੋਇਆ ਪਰ ਉਹ ਆਮ ਲੋਕ ਨੂੰ ਲੋਕਾਂ ਨੂੰ ਤਾਂ ਨਹੀਂ ਨਾ ਫਾਇਦਾ ਹੋਇਆ ਇਸ ਲਈ ਕਿਆ ਏ ਜਿਹੜੇ ਵੀ ਮਤਲਬ ਏਜੰਟਸ ਹੈਗੇ ਆ ਇਹਨਾਂ ਸਾਰਿਆਂ ਨੂੰ ਜੋ ਵੀ ਹੈ ਇਹ ਜੋ ਵੀ ਇਹ ਲੋਕ ਪਿੰਡਾਂ ਦੇ ਵਿੱਚ ਆਉਂਦੇ ਆ ਜਾਂ ਫਿਰ ਸ਼ਹਿਰਾਂ ਦੇ ਵਿੱਚ ਤਾਂ ਪੜ੍ਹੇ ਲਿਖੇ ਲੋਕ ਹੀ ਹੁੰਦੇ ਹਨ ਪਰੰਤੂ ਮਤਲਬ ਪਿੰਡਾਂ ਦੇ ਵਿੱਚ ਮੇਨ ਗੱਲ ਹੈ ਪਿੰਡਾਂ ਦੇ ਵਿੱਚ ਉਹਨਾਂ ਨੂੰ ਮਤਲਬ ਕਿਆ ਏ ਪੰਜਾਬੀ ਭਾਸ਼ਾ ਦਾ ਯੂਜ ਕਰਨਾ ਚਾਹੀਦਾ ਪੰਜਾਬੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਹੋਣੀ ਚਾਹੀਦੀ ਅਤੇ ਜਿਹੜੇ ਉਹ ਦਸਤਾਵੇਜ਼ ਹੁੰਦੇ ਹਨ ਉਹ ਦਸਤਾਵੇਜ਼ ਵੀ ਪੰਜਾਬੀ ਭਾਸ਼ਾ ਦੇ ਵਿੱਚ ਹੋਣੇ ਚਾਹੀਦੇ ਹਨ ਜੇਕਰ ਉਹਨਾਂ ਨੂੰ ਪੰਜਾਬੀ ਆਉਂਦੀ ਹੈ ਠੀਕ ਹੈ ਤਾਂ ਪੰਜਾਬੀ ਭਾਸ਼ਾ ਵਿੱਚ ਆਉਣੇ ਚਾਹੀਦੇ ਹਨ ਜੇਕਰ ਉਹ ਪੜ੍ਹੇ ਲਿਖੇ ਹਨ ਤਾਂ ਉਹ ਜਿਹੜੇ ਹੈਗੇ ਆ ਉਹ ਜਿਹੜੇ ਦਸਤਾਵੇਜ਼ ਆ ਉਹ ਇੰਗਲਿਸ਼ ਵਿੱਚ ਹੋਣ ਪਰੰਤੂ ਦੋਨਾਂ ਲੈਂਗੁਏਜ ਵਿੱਚ ਤਾਂ ਹੋਣੇ ਚਾਹੀਦੇ ਹਨ ਨਾ ਤਾਂ ਕਿ ਉਹ ਸਮਝ ਸਕਣ ਕੀ ਹੈ ਕਿਆ ਏ ਕੋਈ ਸਾਡੇ ਨਾਲ ਧੋਖਾ ਨਾ ਕਰ ਜਾਵੇ ਅਸੀਂ ਧੋਖਾਧੜੀ ਦੇ ਸ਼ਿਕਾਰ ਨਾ ਹੋ ਜਾਈਏ ਇਸ ਦੇ ਲਈ ਕਿਆ ਹੈ ਇਹ ਜੋ ਹੈ ਮਤਲਬ ਜਿਹੜੇ ਦਸਤਾਵੇਜ਼ ਹੈ ਏਜੰਟਸ ਹੈ ਇਹਨਾਂ ਨੂੰ ਪੰਜਾਬੀ ਭਾਸ਼ਾ ਦਾ ਯੂਜ ਕਰਨਾ ਚਾਹੀਦਾ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਦੇ ਨਾਲ ਨਾਲ ਜਿਹੜੇ ਉਹ ਦਸਤਾਵੇਜ਼ ਹੈ ਉਹ ਵਿਸ਼ਵਾਸਯੋਗ ਹੋਣੇ ਚਾਹੀਦੇ ਵਿਸ਼ਵਾਸਯੋਗ ਹੋਣ ਦੇ ਨਾਲ ਨਾਲ ਉਹ ਪੰਜਾਬੀ ਭਾਸ਼ਾ ਦੇ ਵਿੱਚ ਜੋ ਵੀ ਉਸ ਖੇਤਰ ਦੀ ਖੇਤਰੀ ਭਾਸ਼ਾ ਹੈ ਉਹਦੇ ਵਿੱਚ ਜਿਹੜੇ ਦਸਤਾਵੇਜ਼ ਆ ਉਹ ਹੋਣੇ ਚਾਹੀਦੇ ਹਨ ਅਤੇ ਹੁਣ ਮਤਲਬ ਇਹ ਜ਼ਰੂਰੀ ਹੈ ਹੋਣਾ ਤਾਂ ਕਿ ਜਿਹੜੇ ਆਮ ਲੋਕ ਆ ਉਹ ਪਰੇਸ਼ਾਨ ਨਾ ਹੋਣ ਕਿਸੇ ਵੀ ਧੋਖੇਧੜੀ ਦੇ ਸ਼ਿਕਾਰ ਨਾ ਹੋਣ